ਆਵਾਜਾਈ ਯਾਤਰਾ ਲਈ ਬਹੁਤ ਹੀ ਜ਼ਿਆਦਾ ਹੁਣ ਵੱਧਦਾ ਪਿਆ ਅਤੇ ਪਹਿਲਾਂ ਪਹਿਲਾਂ ਲੋਕ ਪੈਦਲ ਹੀ ਜਾਂਦੇ ਸਨ ਅਤੇ ਆਵਾਜਾਈ ਨਹੀਂ ਸੀ ਆਉਂਦੀ ਅਤੇ ਸਾਰਾ ਕੰਮ ਆਪ ਜਾ ਕੇ ਹੀ ਕਰਦੇ ਸਨ ਪਰ ਹੁਣ ਆਵਾਜਾਈ ਵਿੱਚ ਇੰਨਾ ਜ਼ਿਆਦਾ ਵਾਧਾ ਪੈ ਗਿਆ ਕਿ ਹਰ ਇੱਕ ਆਵਾਜਾਈ ਦਾ ਸਾਧਨ ਬਣ ਗਿਆ ਹਰ ਇੱਕ ਆਵਾਜਾਈ ਸਾਧਨ ਜਾਂਦਾ ਗਾ ਜਿਵੇਂ ਕਿ ਹੁਣ ਰੇਲਵੇ ਰੇਲਵੇ ਜਾਂਦੀਆਂ ਗੱਡੀਆਂ ਜਾਂਦੀਆਂ ਹੈਗੀਆਂ ਅਤੇ ਬੱਸਾਂ ਜਾਂਦੀਆਂ ਬੱਸਾਂ ਹੁਣ ਹਰ ਇੱਕ ਚੀਜ਼ ਵਿੱਚ ਏ ਸੀ ਲੱਗ ਗਏ ਅਤੇ ਜਾਣਾ ਵੀ ਆਸਾਨ ਹੋ ਗਿਆ ਪਹਿਲਾਂ ਲੋਕ ਬਹੁਤ ਹੀ ਨਾਲ ਜਾਂਦੇ ਸੀ ਬਹੁਤ ਜ਼ਿਆਦਾ ਭੀੜ ਭੜਾਕਾ ਹੁੰਦਾ ਸੀ ਅਤੇ ਹੁਣ ਇੰਨਾ ਭੀੜ ਭੜਾਕਾ ਵੀ ਨਹੀਂ ਹੁੰਦਾ ਪਹਿਲਾਂ ਮੈਨੂੰ ਪਹਿਲਾਂ ਜਿਵੇਂ ਕਿ ਲੋਕ ਦੋ ਦੋ ਘੰਟਿਆਂ ਵਿੱਚ ਪਹੁੰਚਦੇ ਸਨ ਪਰ ਹੁਣ ਲੋਕ ਘੰਟੇ ਵਿੱਚ ਹੀ ਪਹੁੰਚ ਜਾਂਦੇ ਆ ਅਤੇ ਨਾ ਹੀ ਕਿ ਇੰਨੀ ਜ਼ਿਆਦਾ ਭੀੜ ਹੁੰਦੀ ਆ ਅਤੇ ਬਹੁਤ ਹੀ ਇਨਸਾਨ ਸੀਟਾਂ ਵੀ ਜਲਦੀ ਮਿਲ ਜਾਂਦੀਆਂ ਹੈਗੀਆਂ ਅਤੇ ਬੈਠਣ ਲਈ ਅਤੇ ਵੈਸੇ ਵੀ ਅੱਜ ਕੱਲ੍ਹ ਲੋ ਲੋਕ ਜਦੋਂ ਕੋਈ ਕੋਈ ਯਾਤਰਾ ਯੁਤਰਾ 'ਤੇ ਜਾਂਦਾ ਤਾਂ ਆਵਾਜਾਈ ਸਾਧਨ ਕਰਾਉਣਾ ਹੁੰਦਾ ਤਾਂ ਘਰ ਬੈਠ ਕੇ ਔਨਲਾਈਨ ਹੀ ਕ ਬੁੱਕ ਕਰਾ ਲੈਂਦੇ ਆ ਅਤੇ ਬਹੁਤ ਹੀ ਆਸਾਨ ਨਾਲ ਉੱਥੇ ਪਹੁੰਚ ਜਾਂਦੇ ਆ ਜਿ ਅਤੇ ਆਪਦਾ ਔਨਲਾਈਨ ਬੁੱਕ ਕਰਾ ਕੇ ਲੋਕ ਆਪਦੇ ਮਨਪਸੰਦ ਵਿੱਚ ਹੀ ਉੱਨੀਆਂ ਸੀਟਾਂ ਵੀ ਬੁੱਕ ਕਰਾ ਸਕਦੇ ਆ ਆਪ ਇਕੱਲੇ ਵੀ ਜਾ ਸਕਦੇ ਆ ਅਤੇ ਇਸ ਲਈ ਬਹੁਤ ਹੀ ਜ਼ਿਆਦਾ ਆਵਾਜਾਈ ਵਿੱਚ ਵਾਧਾ ਹੋਇਆ ਅਤੇ ਬਹੁਤ ਹੀ ਜ਼ਿਆਦਾ ਆਵਾਜਾਈ ਦੇ ਸਾਧਨ ਵੀ ਬਹੁਤ ਜ਼ਿਆਦਾ ਚੱਲ ਪਏ ਅਤੇ ਲੋਕਾਂ ਨੂੰ ਜਾਣ ਆਉਣ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਹੋ ਗਈ ਹੁਣ ਆਪ ਦੀ ਆਪ ਹੀ ਲੋਕ ਆਵਾਜਾਈ ਦੇ ਸਾਧਨਾ 'ਤੇ ਜਾ ਸਕਦੇ ਆ